ਹੈਲੋ ਸਤਿ ਸ਼੍ਰੀ ਅਕਾਲ ਸਰ ਹਾਂ ਸਰ ਗੌਰਵ ਬੋਲ ਰਹੇ ਹੋ ਬਰਨਾਲੇ ਤੋਂ ਹਾਂ ਮੈਂ ਪਟਿਆਲਾ ਤੋਂ ਬੋਲ ਰਹੀ ਹਾਂ ਜੀ ਪ੍ਰਿਅੰਕਾ ਅਤੇ ਅਸੀਂ ਨਾ ਮੈਂ ਅਤੇ ਮੇਰੀ ਫੈਮਿਲੀ ਨੇ ਵਿਜਿਟ ਲਈ ਆਉਣਾ ਸੀ ਬਰਨਾਲਾ ਅਤੇ ਉਹ ਅੱਗੋਂ ਅਸੀਂ ਤੁਹਾਡਾ ਨੰਬਰ ਲਿੱਤਾ ਸੀ ਕਿਤੋਂ ਅਤੇ ਉਹ ਸਾਨੂੰ ਗਾਈਡੈਂਸ ਚਾਹੀਦੀ ਸੀਗੀ ਕਿ ਅਸੀਂ ਕਿਸ ਤਰ੍ਹਾਂ ਆਈਏ ਕੈਬ ਤੋਂ ਕਿ ਬੱਸ ਤੋਂ ਪਟਿਆਲੇ ਤੋਂ ਸੀ ਮੈਂ ਹਾਂਜੀ ਹਾਂਜੀ ਸਰ ਮੈਂ ਅਸੀਂ ਪਟਿਆਲਾ ਤੋਂ ਆਉਣਾ ਠੀਕ ਹੈ ਸਰ ਠੀਕ ਹੈ ਜੀ ਜ਼ਿਆਦਾ ਕੰਫਰਟੇਬਲ ਕਿਹੜੀ ਰਹੇਗੀ ਸਰ ਕੈਬ ਕਿ ਬਸ ਠੀਕ ਹੈ ਜੀ ਅਤੇ ਅੱਗੇ ਅਸੀਂ ਘੁੰਮਣ ਵਾਸਤੇ ਦੇਖਣਾ ਸੀ ਕਿ ਉੱਥੇ ਕਿਆ ਕੁਛ ਅਸੀਂ ਦੇਖ ਸਕਦੇ ਹਾਂ ਕੁਛ ਖ਼ਾਸ ਅੱਛਾ ਜੀ ਅੱਛਾ ਜੀ ਕੁਛ ਖ਼ਾਸ ਸਰ ਢਾਬੇ ਦਾ ਉੱਥੇ ਅੱਛਾ ਸਰ ਅੱਛਾ ਜੀ ਠੀਕ ਹੈ ਸਰ ਠੀਕ ਹੈ ਜੀ ਅਤੇ ਹੋਰ ਇਹ ਮਤਲਬ ਸਾਨੂੰ ਮਤਲਬ ਅੱਧਾ ਦਿਨ ਜਾਂ ਕਿੰਨਾ ਕੁ ਟਾਈਮ ਲੱਗ ਜਾਏਗਾ ਮਤਲਬ ਦੇਖਣ 'ਚ ਸਾਰਾ ਕੁਛ ਵੀ ਅਸੀਂ ਸਾਰਾ ਬਰਨਾਲਾ ਘੁਲ ਘੁੰਮ ਲਈਏ ਅੱਛਾ ਸਰ ਠੀਕ ਹੈ ਜੀ ਠੀਕ ਹੈ ਸਰ ਅਤੇ ਹੋਟਲ ਜਿਹਾ ਵਗੈਰਾ ਰੁਕਣ ਲਈ ਕੋਈ ਉੱਥੇ ਮਤਲਬ ਵਧੀਆ ਕੁਛ ਅਰੇਂਜਮੈਂਟ ਹੋਵੇ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਠੀਕ ਹੈ ਸਰ ਅਤੇ ਇੱਕ ਸਰ ਮੈਂ ਆਊਟਲੈਟ ਦਾ ਵੀ ਸੁਣਿਆ ਕੋਈ ਕਿ ਆਊਟਲੈਟ ਬਣਿਆ ਹੋਇਆ ਬਰਨਾਲੇ ਅੱਛਾ ਜੀ ਠੀਕ ਹੈ ਕਿੰਨਾ ਕੁ ਵੱਡਾ ਬਣਿਆ ਹੋਇਆ ਸਰ ਠੀਕ ਹੈ ਜੀ ਇਹ ਕੱਪੜੇ ਵਗੈਰਾ ਦਾ ਹੀ ਹੈ ਕਿ ਮਤਲਬ ਹੋਰ ਵੀ ਗਰੋਸਰੀਜ਼ ਵਗੈਰਾ ਹੁੰਦੇ ਨੇ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਚਲੋ ਅਸੀਂ ਨਾ ਦੇਖਦੇ ਹਾਂ ਅਗਲੇ ਇੱਕ ਦੋ ਦਿਨ ਦੇ ਵਿੱਚ ਪਲੈਨ ਬਣਾ ਰਹੇ ਹਾਂ ਆਉਣ ਦਾ ਅਤੇ ਤੁਸੀਂ ਤੁਹਾਨੂੰ ਅਸੀਂ ਪਹਿਲਾਂ ਇਨਫੋਰਮ ਕਰ ਦਾਂਗੇ ਫਿਰ ਤੁਸੀਂ ਸਾਨੂੰ ਉਦਾਂ ਗਾਈਡ ਕਰ ਦਿਓ ਹਾਂਜੀ ਸਰ ਅਸੀਂ ਦੋ ਕੁ ਦਿਨ ਦੇ ਵਿੱਚ ਵਿਜਿਟ ਕਰਾਂਗੇ ਬਿਲਕੁਲ ਸਰ ਬਿਲਕੁਲ ਜੀ ਠੀਕ ਹੈ ਸਰ ਚਲੋ ਮੈਂ ਤੁਹਾਨੂੰ ਫਿਰ ਕਾਲ ਕਰੂ ਜਦੋਂ ਅਸੀਂ ਆਉਣਾ ਹੋਏ ਠੀਕ ਹੈ ਠੀਕ ਹੈ ਥੈਂਕ